ਹਾਂ ਡਿਜੀਟਲ ਕਲਾ ਕੰਪੂਟਰ ਦੁਬਾਰਾ ਬਣਾਈ ਗਈ ਹੈ ਕਿਉਂਕਿ ਮਨੁੱਖ ਦੁਬਾਰਾ ਬਣਾਈ ਗਈ ਕਲਾ ਚੰਗੀ ਬਹੁਤ ਚੰਗੀ ਹੈ ਕਿਉਂਕਿ ਇਹ ਸਾਡੀ ਮਨੁੱਖ ਦੁਆਰਾ ਜਿਹੜੀ ਬਣਾਈ ਗਈ ਹੁੰਦੀ ਆ ਉਹ ਸਾਡੀਆਂ ਆਰਥਿਕ ਲੋੜਾਂ ਵੀ ਸਮਝਦੀ ਹੈ ਅਤੇ ਅਸੀਂ ਉਹਨੂੰ ਮਨ ਪਰਚਾਵਾ ਵੀ ਕਰ ਸਕਦੇ ਹਾਂ ਕਿਉਂਕਿ ਕੰਪੂਟਰ ਤਾਂ ਆਪਦੇ ਹੀ ਫਾਇਲਾਂ ਦੁਆਰਾ ਫਾਈਲਾਂ ਦੁਆਰਾ ਬਣਾਇਆ ਅ ਆਪ ਹੀ ਤਿਆਰ ਕਰਦਾ ਹੈ ਕਿਉਂਕਿ ਅਸੀਂ ਡਿਜੀਟਲ ਬਲੋ ਡਿਜੀਟਲ ਕਲਾ ਹਾਂ ਕ ਉਹਦਾ ਮਨੁੱਖ ਦਾ ਸਮਾਂ ਬਚਾਉਂਦੀ ਹੈ ਇਸ ਨਾਲ ਹਾਂ ਕਲਾ ਕੀਤੀਆਂ ਜਾ ਸਕਦੀਆਂ ਹਨ ਇਹ ਮਨੁੱਖ ਦੁਆਰਾ ਬਣਾਈ ਕਲਾ ਹੈ ਉਸ ਵਿੱਚ ਸੱਭਿਆਚਾਰ ਸੱਭਿਆਚਾਰ ਚਮਕਦਾ ਹੈ ਅਤੇ ਮਨੁੱਖ ਦਾ ਮਨੁੱਖ ਵੀ ਬਹੁਤ ਚਮਕਦਾ ਹੈ ਕਿਉਂਕਿ ਡਿਜੀਟਲ ਕਲਾ ਹਾਂ ਕੰਪੂਟਰ ਦੁਆਰਾ ਹੀ ਬਣਾਈ ਬ ਬਣਦੀ ਹੈ ਕਿਉਂਕਿ ਉਹ ਅਸੀਂ ਕੰਪੂਟਰ ਨੂੰ ਤਾਂ ਉਹ ਆਪਦੀਆਂ ਫਾਈਲਾਂ ਦਾ ਕਿਉਂਕਿ ਅਸੀਂ ਉਹਨੂੰ ਤਾਂ ਦੱਸ ਨਹੀਂ ਸਕਦੇ ਵੀ ਅਸੀਂ ਹਾਂ ਕਿ ਵੀ ਉਹ ਕਿਵੇਂ ਕਰ ਸਕਦਾ ਹੈ ਕਿਉਂ ਮਨੁੱਖ ਤਾਂ ਸਾਡੇ ਆ ਆਪ ਹੀ ਦੱਸ ਸਕਦਾ ਹੈ ਵੀ ਕਿਵੇਂ ਬਣਦੀ ਹੈ ਕਿੱਦਾਂ ਕਿਵੇਂ ਤਿਆਰ ਹੁੰਦੀ ਹੈ ਇਸ ਲਈ ਸਾਨੂੰ ਡਿਜੀਟਲ ਕਲਾ ਕਲਾ ਤਾਂ ਸਮਾਂ ਬਚਾਉਂਦੀ ਆ ਪਰ ਮਨੁੱਖ ਦਾ ਪ ਪਰ ਇੰਨਾ ਵਧੀਆ ਨਹੀਂ ਸ ਉਹ ਹੁੰਦਾ